ਪੰਜਾਬ ਵਿੱਚ ਆਮ ਜ਼ੁਕਾਮ ਦੇ ਇਲਾਜ ਕੀਤੇ ਜਾਂਦੇ ਹਨ ਘਰੇਲੂ ਨੁਸਖਿਆ ਨਾਲ ਜਿਵੇਂ ਕਿ ਪੁਰਾਣੇ ਬਜ਼ੁਰਗ ਦੱਸ ਰਹੇ ਦੱਸਦੇ ਹੁੰਦੇ ਸੀ ਕਿ ਸੁੱਕੇ ਚਣੇ ਭੁੰਨੇ ਹੋਏ ਚਣੇ ਕੜਾਹ ਬਣਾ ਕੇ ਖਾਇਆ ਜਾਂਦਾ ਬੇਸਣ ਦਾ ਕੜਾਹ ਬਣਾ ਕੇ ਖਾਇਆ ਜਾਂਦਾ ਸੀ ਅਤੇ ਦਾਦੀਆਂ ਦੱਸਦੀਆਂ ਹੁੰਦੀਆਂ ਸੀ ਕਿ ਗਰਮ ਪਾਣੀ ਕਰਕੇ ਵਿੱਚ ਅਦਰਕ ਪਾ ਕੇ ਉਸ ਦੀ ਭਾਫ਼ ਲੈਣੀ ਇਸ ਕਰਕੇ ਜ਼ੁਕਾਮ ਠੀਕ ਹੋ ਜਾਂਦਾ ਸੀ ਹੋਰ ਵੀ ਕਾਫ਼ੀ ਘਰੇਲੂ ਨੁਸਖੇ ਹਨ ਜਿਹਨਾਂ ਕਰਕੇ ਜ਼ੁਕਾਮ ਠੀਕ ਹੋ ਜਾਂਦਾ ਹੈ ਅਤੇ ਇਸ ਕਰਕੇ ਸਾਨੂੰ ਦਵਾਈ ਲੈਣ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਘਰੇਲੂ ਨੁਸਖਿਆਂ ਨਾਲ ਹੀ ਆਮ ਜ਼ੁਕਾਮ ਠੀਕ ਹੋ ਜਾਂਦਾ ਹੈ ਅਤੇ ਇਸ ਕਰਕੇ ਜ਼ੁਖਾਮ ਅਰਾਮ ਨਾਲ ਠੀਕ ਹੋ ਜਾਂਦਾ ਹੈ